ਜੀ ਹਾਂ ਮੈਂ ਆਪਣੇ ਡਰਾਇੰਗ ਵਿੱਚ ਗਤੀਸ਼ੀਲਤਾ ਲਿਆ ਸਕਦੀ ਹਾਂ ਗਤੀਸ਼ੀਲਤਾ ਦਾ ਮਤਲਬ ਹੁੰਦਾ ਹੈ ਕਿ ਮੈਂ ਉਸ ਨੂੰ ਕਿਵੇਂ ਇੱਕ ਬਹੁਤ ਹੀ ਜ਼ਿਆਦਾ ਵਧੀਆ ਬਣਾ ਸਕਦੀ ਹਾਂ ਡਰੋਇੰਗ ਨੂੰ ਕਿਵੇਂ ਬਹੁਤ ਜ਼ਿਆਦਾ ਵਧੀਆ ਬਣਾ ਸਕਦੀ ਹਾਂ ਅਤੇ ਮੈਂ ਇਸ ਦਾ ਉਪਯੋਗ ਹਾਂ ਕੀਤਾ ਸੀਗਾ ਇੱਕ ਵਾਰ ਮੈਂ ਰੋਡ 'ਤੇ ਆਪਣੀ ਮੰਮੀ ਨਾਲ ਸਬਜ਼ੀ ਲੈਣ ਜਾ ਰਹੀ ਉੱਥੇ ਇੱਕ ਗਰੀਬ ਕੁੜੀ ਆਪਣੇ ਗੁਬਾਰੇ ਵੇਚ ਰਹੇ ਸੀ ਅਤੇ ਮੈਂ ਆਪਣੀ ਡਰੋਇੰਗ ਦੇ ਡਰੋਇੰਗ ਦੇ ਕਾਰਨ ਡਹੋ ਡਰੋਇੰਗ ਦੀ ਸਹਾਇਤਾ ਨਾਲ ਉਸਦੀ ਇੱਕ ਚਿੱਤਰਕਾਰ ਦਾ ਚਿੱਤਰਕਾਰਤਾ ਬਣਾਈ ਜਿਹਦੇ ਵਿੱਚ ਮੈਂ ਉਸ ਨੂੰ ਗੁਬਾਰੇ ਵੇਚਣ ਵਾਲੀ ਕੁੜੀ ਦਾ ਸਥਾਨ ਦਿੱਤਾ ਜਿਹਦੇ ਵਿੱਚ ਉਹ ਆਪਣੇ ਗੁਬਾਰੇ ਵੇਚ ਰਹੀ ਸੀ ਅਤੇ ਮੈਂ ਉਸ ਵਿੱਚ ਉਸ ਦੇ ਮੋਸ਼ਨ ਲਾਉਣ ਦੀ ਵੀ ਪੂਰੀ ਪੂਰੀ ਕੋਸ਼ਿਸ਼ ਕੀਤੀ ਸੀਗੀ ਜਦੋਂ ਜਿਸ ਤਰ੍ਹਾਂ ਉਹ ਥੋੜ੍ਹੀ ਜਿਹੀ ਉਦਾਸ ਬੈਠੀ ਸੀ ਮੈਂ ਉਸਦਾ ਪੂਰਾ ਪੂਰਾ ਉਦਾਸੀ ਵਾਲਾ ਮਨ ਬਣਾਇਆ ਅਤੇ ਮੈਂ ਪੂਰਾ ਪੂਰਾ ਇਹ ਝਲਕਾਇਆ ਕਿ ਉਸ ਨੂੰ ਪੈਸਿਆਂ ਦੀ ਪੂਰੀ ਲੋੜ ਹੈ ਅਤੇ ਉਹ ਛੋਟੀ ਜਿਹੀ ਬੱਚੀ ਹੈ ਅਤੇ ਮੈਂ ਉਹਦੇ ਉੱਤੇ ਸਾਈਡ 'ਤੇ ਇਹ ਵੀ ਲਿਖਿਆ ਕਿ ਉਹਨੂੰ ਕੰਮ ਕਰਨ ਤੋਂ ਇਲਾਵਾ ਉਹਨੂੰ ਪੜ੍ਹਨਾ ਚਾਹੀਦਾ ਹੈ ਹਾਂ ਅਗਰ ਉਹ ਕੰਮ ਕਰ ਰਹੀ ਹੈ ਆਪਣਾ ਪਰਿਵਾਰ ਚਲਾਉਣ ਵਾਸਤੇ ਉਹ ਉਹਦੀ ਕੋਈ ਗਲਤੀ ਨਹੀਂ ਹੈ ਪਰ ਸਾਨੂੰ ਉਸਦੀ ਪੂਰੀ ਪੂਰੀ ਸਹਾਇਤਾ ਕਰਨੀ ਚਾਹੀਦੀ ਹੈ ਕਿ ਉਹ ਪੜ੍ਹੇ ਇਸ ਤਰ੍ਹਾਂ ਮੈਂ ਆਪਣੀ ਗਤੀਸ਼ੀਲਤਾ ਦੇ ਕਾਰਨ ਉਸ ਦੇ ਇੱਕ ਚਿੱਤਰਕਾਰ ਵਿੱਚ ਉਸ ਦੀ ਪੂਰੀ ਫੋਟੋ ਨਾਲ ਗੁਬਾਰੇ ਨਾਲ ਪੜ੍ਹਾਈ ਨਾਲ ਪੈਸਾ ਸਭ ਕੁਛ ਬਣਾਇਆ